ਚਿੱਤਰ ਬਣਾਉਣ ਦੀ ਪ੍ਰਕਿਰਿਆ ਨੂੰ ਦੇਖੀਏ ਤਾਂ ਕੁਝ ਦਿਨ ਪਹਿਲਾਂ ਮੈਂ ਟਿੱਬੀ ਸਾਹਿਬ ਦਾ ਚਿੱਤਰ ਬਣਾਇਆ ਸੀ ਜਿਸ ਨੂੰ ਕਿ ਦਰਿਆ ਦੇ ਦੂਜੇ ਕਿਨਾਰੇ ਖੜ੍ਹੇ ਹੋ ਕੇ ਸਾਰੀ ਚਿੱਤਰਕਾਰੀ ਕੀਤੀ ਸੀ ਪਾਣੀ ਦਾ ਰੁੱਖ ਕਿਸ ਤਰ੍ਹਾਂ ਦਾ ਸੀਗਾ ਉਹ ਦਿਖਾਇਆ ਗਿਆ ਅਤੇ ਟਿੱਬੀ ਸਾਹਿਬ ਦਾ ਚਿੱਤਰ ਬਹੁਤ ਹੀ ਵਧੀਆ ਬਣਿਆ ਜਿਹਦੇ 'ਚ ਮੇਰੇ ਦੋ ਤਿੰਨ ਦਿਨ ਲੱਗ ਗਏ ਮੈਨੂੰ ਪਤਾ ਹੀ ਨਹੀਂ ਲੱਗਿਆ ਕਿਸ ਤਰ੍ਹਾਂ ਇਹ ਹੋਇਆ